ਮੈਨੂੰ ਲੱਗਦਾ ਹੈ ਅੱਜ ਦੇ ਟਾਈਮ ਕੋਈ ਵੀ ਇਨਸਾਨ ਇੰਟਰਨੈਟ ਤੋਂ ਬਿਨਾਂ ਨਹੀਂ ਰਹਿ ਸਕਦਾ ਇੰਟਰਨੈਟ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕਿਆ ਹੈ ਅੱਜ ਅਸੀਂ ਕੁਛ ਵੀ ਕਰਨਾ ਹੋ ਕਿਤੇ ਬਾਹਰ ਜਾਣਾ ਹੋ ਕੋਈ ਟਿਕਟਾਂ ਬੁੱਕ ਕਰਨੀਆਂ ਹੋ ਕੁਛ ਪੜ੍ਹਨਾ ਹੋਵੇ ਜਾਂ ਕਿਤੇ ਪੈਸੇ ਦਾ ਲੈਣ ਦੇਣ ਹੀ ਕਰਨਾ ਹੋਵੇ ਬਿਨਾਂ ਇੰਟਰਨੈਟ ਤੋਂ ਕੁਝ ਵੀ ਸੰਭਵ ਨਹੀਂ ਹੈ ਪਹਿਲਾਂ ਦੇ ਸਮੇਂ ਅਸੀਂ ਦੇਖਦੇ ਸੀ ਕਿ ਕਦੇ ਕਿਸੇ ਨੇ ਫੋਨ ਕਰਨਾ ਹੁੰਦਾ ਸੀ ਤਾਂ ਮਹੀਨੇ ਮਹੀਨੇ ਗੱਲ ਨਹੀਂ ਹੋ ਪਾਉਂਦੀ ਸੀ ਕਿਉਂ ਕਿਉਂਕਿ ਸਾਡੇ ਕੋਲ ਫੋਨ ਦੀ ਸੁਵਿਧਾ ਨਹੀਂ ਸੀ ਅਸੀਂ ਕਿਸੇ ਨੂੰ ਮੈ ਚਿੱਠੀ ਪਾਉਣੀ ਹੁੰਦੀ ਸੀ ਕਿਸੇ ਨਾਲ ਕੋਈ ਗੱਲ ਕਰਨੀ ਹੁੰਦੀ ਸੀ ਤਾਂ ਅਸੀਂ ਚਿੱਠੀ ਪਾਉਂਦੇ ਸੀ ਫਿਰ ਉਸ ਚਿੱਠੀ ਦਾ ਜਵਾਬ ਅਸੀਂ ਮਹੀਨੇ ਮਹੀਨੇ ਕਈ ਕਈ ਦਿਨਾਂ ਤੱਕ ਕਰਦੇ ਰਹਿੰਦੇ ਸੀ ਪਰ ਜੇਕਰ ਹੁਣ ਅਸੀਂ ਅੱਜ ਦੇਖਦੇ ਹਾਂ ਤਾਂ ਟੈਕਨੋਲੋਜੀ ਨੇ ਸਾਨੂੰ ਇੰਨਾ ਕੁ ਫ਼ਾਇਦਾ ਕਰ ਦਿੱਤਾ ਹੈ ਕਿ ਅਸੀਂ ਮਿੰਟੋ ਮਿੰਟ ਘਰੋਂ ਘਰ ਬੈਠ ਕੇ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਾਂ ਔਰ ਇਹ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਸਾਡੇ ਕੋਲ ਅੱਜ ਇੰਟਰਨੈਟ ਦੀ ਸੁਵਿਧਾ ਹੈ ਇੰਟਰਨੈਟ ਰਾਹੀਂ ਅਸੀਂ ਇੱਕ ਦੂਜੇ ਨੂੰ ਜਦ ਮਰਜ਼ੀ ਮੈਸੇਜ ਕਰ ਸਕਦੇ ਹਾਂ ਅਸੀਂ ਕਿਸੇ ਨਾਲ ਗੱਲ ਕਰਨੀ ਹੋਵੇ ਤਾਂ ਅਸੀਂ ਆਰਾਮ ਨਾਲ ਕਰ ਸਕਦੇ ਹਾਂ ਪਹਿਲਾਂ ਦੇ ਸਮੇਂ ਵਿੱਚ ਲੋਕ ਇੱਕ ਦੂਜੇ ਦੀ ਸ਼ਕਲ ਦੇਖਣ ਲਈ ਵੀ ਤਰਸ ਜਾਂਦੇ ਸੀ ਪਰ ਹੁਣ ਅੱਜ ਕੱਲ੍ਹ ਵੀਡੀਓ ਕਾਲ ਦੇ ਰਾਹੀਂ ਇਹ ਪ੍ਰੋਬਲਮ ਵੀ ਖਤਮ ਹੋ ਗਈ ਹੈ ਅਸੀਂ ਆਰਾਮ ਨਾਲ ਆਪਣੇ ਫੋਨਾਂ ਰਾਹੀਂ ਬੈਠੇ ਹੋਏ ਆਪਣੇ ਘਰਾਂ ਵਿੱਚ ਜਦੋਂ ਮਰਜ਼ੀ ਦਿਨ ਰਾਤ ਸਵੇਰ ਦੁਪਹਿਰ ਅਸੀਂ ਕਿਸੇ ਨੂੰ ਵੀ ਵੀਡੀਓ ਕਾਲ ਲਗਾ ਕੇ ਉਹਨਾਂ ਦੀ ਸ਼ਕਲ ਦੇਖ ਸਕਦੇ ਹਨ ਅਤੇ ਉਹਨਾਂ ਨਾਲ ਗੱਲਾਂ ਕਰ ਸਕਦੇ ਹਾਂ ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਇੰਟਰਨੈਟ ਤੋਂ ਬਿਨਾਂ ਅੱਜ ਕੱਲ੍ਹ ਕੋਈ ਵੀ ਨਹੀਂ ਰਹਿ ਸਕਦਾ ਚਾਹੇ ਉਹ ਕੋਈ ਬੱਚਾ ਹੋਵੇ ਕੋਈ ਜਵਾਨ ਹੋਵੇ ਕੋਈ ਬਜ਼ੁਰਗ ਹੋਵੇ ਇੰਟਰਨੈਟ ਤੋਂ ਬਿਨਾਂ ਕਿਸੇ ਦੀ ਜ਼ਿੰਦਗੀ ਨਹੀਂ ਚੱਲਦੀ ਹੁਣ ਤਾਂ ਇੰਨੀ ਕੁ ਸੌਖ ਹੋ ਗਈ ਹੈ ਕਿ ਸਾਡੇ ਕੋਲ ਜੇ ਖੜੇ ਪੈਰ ਕੈਸ਼ ਨਹੀਂ ਵੀ ਹੈਗਾ ਪੈਸੇ ਨਹੀਂ ਵੀ ਹੈਗੇ ਤਾਂ ਅਸੀਂ ਫੋਨ ਦੇ ਰਾਹੀਂ ਗੂਗਲ ਪੇ ਦੇ ਰਾਹੀਂ ਅਸੀਂ ਇੱਕ ਦੂਜੇ ਨੂੰ ਪੈਸੇ ਦੇ ਲੈ ਸਕਦੇ ਹਾਂ ਇਹ ਕਿਸ ਕਰਕੇ ਸੰਭਵ ਹੋਇਆ ਹੈ ਟੈਕਨੋਲੋਜੀ ਕਰਕੇ ਜੋ ਕਿ ਹੈ ਇੰਟਰਨੈਟ ਇੰਟਰਨੈਟ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਸੌਖਾ ਕਰ ਦਿੱਤਾ ਹੈ ਚਾਹੇ ਬੱਚੇ ਹੋਣ ਅੱਜ ਕੱਲ੍ਹ ਗੇਮਾਂ ਖੇਡਦੇ ਹਨ ਛੋਟੇ ਬੱਚੇ ਤਾਂ ਰੋਟੀ ਵੀ ਤਾਂ ਹੀ ਖਾਂਦੇ ਹਨ ਜਦ ਉਹਨਾਂ ਦੇ ਹੱਥ ਵਿੱਚ ਫੋਨ ਆਉਂਦਾ ਹੈ ਬੱਚੇ ਵੀ ਅੱਜ ਕੱਲ੍ਹ ਕਿਤਾਬਾਂ ਨੂੰ ਪੜ੍ਹਨਾ ਪਸੰਦ ਨਹੀਂ ਕਰਦੇ ਉਹ ਕਹਿੰਦੇ ਅਸੀਂ ਆਨਲਾਈਨ ਪੜ੍ਹਨਾ ਹੈ ਇਹ ਕਿਸ ਤਰ੍ਹਾਂ ਸੰਭਵ ਹੋਇਆ ਹੈ ਇੰਟਰਨੈਟ ਦੇ ਰਾਹੀਂ ਇਸ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਇੰਟਰਨੈਟ ਤੋਂ ਬਿਨਾਂ ਸਾਡੀ ਜ਼ਿੰਦਗੀ ਬੜੀ ਮੁਸ਼ਕਿਲ ਹੋ ਜਾਵੇਗੀ ਅਤੇ ਅਸੀਂ ਹੁਣ ਇੰਨਾ ਕੁ ਉਹਨਾਂ ਉਹਦਾ ਪ੍ਰਭਾਵ ਆਪਣੇ ਉੱਪਰ ਪਾ ਸਕਦੇ ਹਾਂ ਕਿ ਆਪਾਂ ਚਾਹੁੰਦੇ ਹੋਏ ਵੀ ਹੁਣ ਇੰਟਰਨੈਟ ਤੋਂ ਬਿਨਾਂ ਨਹੀਂ ਰੁਕ ਸਕਦੇ ਇਸ ਲਈ ਇੰਟਰਨੈਟ ਸਾਡੀ ਜ਼ਿੰਦਗੀ ਨੂੰ ਬਹੁਤ ਚੰਗੇ ਤਰੀਕੇ ਨਾਲ ਵੀ ਪ੍ਰਭਾਵਿਤ ਕੀਤਾ ਹੈ ਤੇ ਕਈ ਵਾਰ ਅਸੀਂ ਕਹਿ ਸਕਦੇ ਹਾਂ ਕਿ ਬੁਰੇ ਤਰੀਕੇ ਨਾਲ ਵੀ ਕੀਤਾ ਹੈ ਉਹ ਇਸ ਲੀਏ ਅਗਰ ਆਪਾਂ ਅੰਨ੍ਹੇਵਾਹ ਹਰ ਚੀਜ਼ ਨੂੰ ਯੂਜ ਕਰੀ ਜਾਵਾਂਗੇ ਕਰੀ ਜਾਵਾਂਗੇ ਤੋ ਕਹੀਂ ਨਾ ਕਹੀਂ ਸਾਡੇ ਉੱਤੇ ਬੁਰਾ ਪ੍ਰਭਾਵ ਵੀ ਪਾ ਸਕਦਾ ਹੈ ਪਰ ਜੇਕਰ ਅਸੀਂ ਦੇਖੀਏ ਕਿ ਸਭ ਜਿਸ ਤੋਂ ਬਿਨਾਂ ਆਪਾਂ ਰਹਿ ਨਹੀਂ ਸਕਦੇ ਤਾਂ ਉਹ ਇੰਟਰਨੈਟ ਹੀ ਆ ਕਿਉਂਕਿ ਇਸ ਦੇ ਨੁਕਸਾਨ ਤੋਂ ਜ਼ਿਆਦਾ ਇਸ ਦੇ ਫ਼ਾਇਦੇ ਹਨ ਜੋ ਕਿ ਸਾਡੀ ਜ਼ਿੰਦਗੀ ਨੂੰ ਬਹੁਤ ਸੌਖਾ ਬਣਾ ਰਹੇ ਹਨ